ਮੈਂ ਰਵਿੰਦਰ ਸਿੰਘ ਮੇਰੀ ਯੋਗਤਾ ਪੋਸਟ ਗ੍ਰੈਜੂਏਸ਼ਨ ਹੈ ਮੈਂ ਅੱਜ ਦੇ ਸਮੇਂ ਵਿੱਚ ਪੇਸ਼ੇ ਵਜੋਂ ਦੌੜਨ ਲਈ ਕਿਸੇ ਵੀ ਚੀਜ਼ ਦੀ ਪ੍ਰੀਤ ਕੀਤਾ ਗਿਆ ਹਾਂ ਕਿ ਮੈਨੂੰ ਇੱਕ ਸਰਕਾਰੀ ਨੌਕਰੀ ਰੁਜ਼ਗਾਰ ਮਿਲ ਸਕੇ ਮੈਂ ਥਾਂ ਥਾਂ 'ਤੇ ਭੱਜ ਦੌੜ ਕਰ ਰਿਹਾ ਹਾਂ ਜਿੱਥੇ ਹੀ ਮੈਨੂੰ ਦੱਸ ਪੈਂਦੀ ਹੈ ਕਿ ਵੀ ਤੁਹਾਡੀ ਦੀ ਤੁਹਾਡੀ ਯੋਗਤਾ ਅਨੁਸਾਰ ਉੱਥੇ ਭਰਤੀ ਹੈ ਜਾਂ ਕਿਤੇ ਸਰਕਾਰੀ ਮਹਿਕਮੇ ਦੇ ਵਿੱਚ ਭਰਤੀ ਹੈ ਮੈਂ ਆਪਣੀ ਯੋਗਤਾ ਅਨੁਸਾਰ ਅਪਲਾਈ ਕਰਦਾ ਹਾਂ ਅਤੇ ਕੁਝ ਕਾਰਨਾਂ ਕਾਰਨ ਮੈਂ ਪਿੱਛੇ ਰਹਿ ਜਾਂਦਾ ਹਾਂ ਅਤੇ ਮੈਨੂੰ ਪ੍ਰਾਪਤੀ ਨਹੀਂ ਮਿਲਦੀ ਪੇਸ਼ੇ ਵਜੋਂ ਮੈਂ ਦੌੜਦਾ ਫਿਰਦਾ ਆ ਮੇਰੀ ਉਮਰ ਅਠਾਈ ਸਾਲ ਹੋ ਚੁੱਕੀ ਹੈ ਅਤੇ ਮੈਂ ਹਾਲੇ ਤੱਕ ਇਸ ਪੇਸ਼ੇ ਨਾ ਮਿਲਣ ਕਾਰਨ ਮੈਂ ਆਪਣਾ ਵਿਆਹ ਵੀ ਨਹੀਂ ਕਰਵਾ ਸਕਦਾ ਕਿਉਂਕਿ ਵਿਆਹ ਕਰਵਾਉਣ ਲਈ ਵੀ ਪੈਰਾਂ 'ਤੇ ਖੜ੍ਹਾ ਹੋਣਾ ਜ਼ਰੂਰੀ ਹੈ ਪੈਰਾਂ 'ਤੇ ਖੜ੍ਹਾ ਹੋਣ ਲਈ ਮੇਰੇ ਕੋਲ ਸਰਕਾਰੀ ਜਾਂ ਪ੍ਰਾਈਵੇਟ ਕੋਈ ਰੁਜ਼ਗਾਰ ਨਹੀਂ ਹੈ ਮੈਂ ਹਾਲੇ ਤੱਕ ਬੇਰੁਜ਼ਗਾਰ ਹੀ ਤੁਰਿਆ ਫਿਰਦਾ ਹਾਂ ਅਤੇ ਘਰਦਿਆਂ 'ਤੇ ਬੋਝ ਬਣਿਆ ਹੋਇਆ ਹਾਂ ਇੱਕ ਮੈਨੂੰ ਵੀ ਸਰਕਾਰੀ ਨੌਕਰੀ ਚਾਹੀਦੀ ਹੈ ਮੇਰੀ ਯੋਗਤਾ ਅਨੁਸਾਰ ਮੈਂ ਵੀ ਈ ਟੀ ਟੀ ਕੀਤੀ ਹੋਈ ਹੈ ਟੀਚਰ ਕੋਰਸ ਕੀਤਾ ਹੋਇਆ ਪੀ ਐਸ ਟੈਟ ਮੇਰਾ ਕਲੀਅਰ ਹੈ ਅਤੇ ਇਸ ਦੇ ਅਧਾਰਿਤ ਮੈਨੂੰ ਸਰਕਾਰੀ ਨੌਕਰੀ ਮਿਲਣੀ ਚਾਹੀਦੀ ਹੈ ਮੇਰੀ ਭੱਜ ਦੌੜ ਖਤਮ ਹੋਣੀ ਚਾਹੀਦੀ ਹੈ ਸਰੀਰਕ ਸ਼ਕਤੀਆਂ ਮੈਂ ਮੇਰਾ ਹ ਮੇਰਾ ਕੱਦ ਛੇ ਫੁੱਟ ਇੱਕ ਇੰਚ ਹੈ ਅਤੇ ਮੈਂ ਵਧੀਆ ਇੱਕ ਸਿਹਤਮੰਦ ਸਰੀਰ ਵਾਲਾ ਵਿਅਕਤੀ ਹਾਂ ਅਤੇ ਮੇਰੀ ਮੇ ਮੇਰੀ ਪੰਜਾਬ ਪੁਲਿਸ ਦੋ ਹਜ਼ਾਰ ਸੋਲ੍ਹਾਂ ਦੇ ਵਿੱਚ ਭਰਤੀ ਹੋਣ ਤੋਂ ਇੱਕ ਪੁਆਇੰਟ ਘੱਟ ਕੱਦ ਲੱਗਣ ਕਾਰਨ ਮੇਰੀ ਯੋਗਤਾ ਰਹਿ ਗਈ ਛੱਬੀ ਨੰਬਰ ਬਣੇ ਸੀਗੇ ਸਤਾਈ ਨੰਬਰ ਚਾਹੀਦੇ ਸੀਗੇ ਤਾਂ ਕਰਕੇ ਇਸ ਵਿੱਚ ਨਾਕਾਮੀ ਹਾਸਲ ਹੋਈ ਮੈਨੂੰ